ਬੁਣਾਈ ਕਰਦੇ ਹੋਏ ਇੱਕ ਵਾਰ ਮੈਂ ਅੱਧੇ ਤੋਂ ਜ਼ਿਆਦਾ ਸਵੈਟਰ ਬਣਾ ਲਿਆ ਸੀ ਪਰ ਬਾਅਦ 'ਚ ਸਮਝ ਆਇਆ ਕਿ ਇਹ ਤਾਂ ਗਲ਼ਤ ਬਣ ਗਿਆ ਹੈ ਫਿਰ ਮੈਂ ਕਾਫੀ ਸਾਰਾ ਉਧੇੜ ਕੇ ਬਣਾਇਆ ਮਿਹਨਤ ਤਾਂ ਕਾਫੀ ਗਈ ਪਰ ਸਮਝ ਆ ਗਈ ਵੀ ਅੱਗੇ ਤੋਂ ਜੇ ਇੱਦਾਂ ਦਾ ਕੁਛ ਬਣਾਉਣਾ ਹੈ ਤਾਂ ਪਹਿਲਾਂ ਸੋਚ ਕੇ ਹੀ ਫਿਰ ਬਣਾਉਣਾ ਹੈ ਬਾਕੀ ਹਰ ਸਮੱਸਿਆ ਦਾ ਹੱਲ ਹੁੰਦਾ ਹੈ ਜੇ ਕੋਈ ਜ਼ਿੰਦਗੀ ਵਿੱਚ ਸਮੱਸਿਆ ਵੀ ਆਉਂਦੀ ਹੈ ਤਾਂ ਉਸ ਨੂੰ ਦੂਰ ਕੀਤਾ ਜਾ ਸਕਦਾ ਹੈ